ਪੰਜਾਬੀ ਭਾਸ਼ਾ ਬਾਰੇ ਅੱਜ ਕੱਲ੍ਹ ਕਾਫੀ ਲੋਕ ਇਹ ਬੋਲਦੇ ਨੇ ਕਿ ਇਹ ਗਵਾਰਾਂ ਦੀ ਭਾਸ਼ਾ ਹੁੰਦੀ ਹੈ ਅਤੇ ਜਿਹੜੇ ਬੰਦੇ ਇਹਨੂੰ ਬੋਲਦੇ ਆ ਉਹ ਅੱਗੇ ਕੁਛ ਨਹੀਂ ਕਰ ਸਕਦੇ ਇਹ ਚੀਜ਼ ਬਹੁਤ ਗਲਤ ਹੈਗੀ ਕਿਉਂਕਿ ਜਿਵੇਂ ਜਿਹੜਾ ਬੰਦਾ ਪੰਜਾਬੀ ਬੋਲੇ ਉਹ ਗਵਾਰ ਨਹੀਂ ਹੈਗਾ ਅਤੇ ਉਹਨੂੰ

ਵਿਅਕਤ ਕਰਦੀ ਹੈ ਇਹ ਪੰਜਾਬੀ ਭਾਸ਼ਾ ਸਾਡੀ ਕੌਮ ਦੀ ਸ਼ਾਨ ਹੈ ਆਨ ਹੈ ਅਤੇ ਮਾਣ ਹੈ ਅਤੇ ਸਾਨੂੰ ਪੰਜਾਬੀ ਬੋਲਦੀ ਰਹਿਣੀ ਚਾਹੀਦੀ ਹੈ ਅਤੇ ਜਿਹੜਾ ਸਾਨੂੰ ਪੰਜਾਬੀ ਮਿਲੇ ਉਹਦੇ ਨਾਲ ਪੰਜਾਬੀ ਹੀ ਬੋਲਣੀ ਚਾਹੀਦੀ ਹੈ ਸਾਨੂੰ ਕਦੇ ਵੀ ਪੰਜਾਬੀ ਬੋਲਣ ਦਾ ਸੰਕੋਚ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਾਡੀ ਮਾਤਰ ਭਾਸ਼ਾ ਹੈ ਅਤੇ ਇਹ ਸਾਡੀ ਕੌਮ ਦੀ ਸ਼ਾਨ ਹੈ ਸਾਨੂੰ ਪੰਜਾਬੀ ਭਾਸ਼ਾ ਨੂੰ ਬਚਾ ਕੇ ਰੱਖਣਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ ਭਾਸ਼ਾ ਸਟਾਰਟ ਕੀਤੀ ਸੀ ਅਤੇ ਸਾਨੂੰ ਇਹ ਬਚਾ ਕੇ ਰੱਖਣੀ ਚਾਹੀਦੀ ਹੈ ਸਾਡਾ ਧਰਮ ਬਣਦਾ ਹੈ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਸਮਝਾ ਸੰਭਾਲ ਕੇ ਰੱਖੀਏ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਦੇ ਚਲੀਏ ਅਤੇ ਜਿਹੜਾ ਵੀ ਕੋਈ ਸਾਨੂੰ ਦਿਖੇ ਕਿ ਜੋ ਕਹਿੰਦਾ ਕਿ ਇਹ ਪੰਜਾਬੀ ਲੋਕ ਗਵਾਰ ਹੁੰਦੇ ਤਾਂ ਉਹਨਾਂ ਨੂੰ ਅਸੀਂ ਦੱਸੀਏ ਅਤੇ ਉਹਨਾਂ ਨੂੰ ਸਹੀ ਕਰੀਏ ਕਿ ਪੰਜਾਬੀ ਬੋਲਣ ਵਾਲੇ ਕਦੇ ਗਵਾਰ ਨਹੀਂ ਹੁੰਦੇ ਉਹ ਸਗੋਂ ਦਲੇਰ ਹੁੰਦੇ ਕਿਉਂਕਿ ਜਿਹੜਾ ਬੰਦਾ ਪੰਜਾਬੀ ਹੋਵੇ ਅਤੇ ਪੰਜਾਬੀ ਬੋਲਦਾ ਹੋਵੇ ਸ਼ੇਰ ਅਤੇ ਦਲੇਰ ਹੁੰਦਾ ਹੈ